ਹੈਲੋ ਹਾਂਜੀ ਹਾਂਜੀ ਬੋਲੋ ਅੱਛਾ ਕਿਸ ਚੀਜ ਦੇ ਫੁੱਲਾਂ ਦੇ ਸਬਜ਼ੀਆਂ ਦੇ ਫਰੂਟ ਦੇ ਕਿਸ ਚੀਜ਼ ਦੇ ਚਾਹੀਦੇ ਸੀਗੇ ਸਬਜ਼ੀਆਂ ਤੁਸੀਂ ਘਰ ਹੀ ਖੇਤੀ ਕਰਨ ਘਰ ਖੇਤੀ ਲਗਾਉਣੀ ਆ ਜਾਂ ਖੇਤ ਦੇ ਵਿੱਚ ਅੱਛਾ ਅਤੇ ਪਹਿਲਾਂ ਕੀਤੀ ਪਹਿਲਾਂ ਲਾਏ ਹੋਏ ਆ ਅੱਛਾ ਅੱਛਾ ਕੋਈ ਗੱਲ ਨਹੀਂ ਸਾਡੀ ਦੁਕਾਨ 'ਤੇ ਵਧੀਆ ਉਹ ਤੁਹਾਨੂੰ ਸੀਡਸ ਮਿਲਣ ਮਿਲ ਜਾਣਗੇ ਅਤੇ ਇੱ ਸਾਡੇ ਬਹੁਤ ਬਹੁਤ ਬਹੁਤ ਵ ਬਹੁਤ ਸਾਡੇ ਕਸਟਮਰ ਵੀ ਹੈਗੇ ਨੇ ਇੱਥੇ ਦੇ ਲੋਕਲ ਜੋ ਸਾਡੇ ਕੋਲੋਂ ਹੀ ਲੈ ਕੇ ਜਾਂਦੇ ਨੇ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਸਾਡੇ ਕੋਲ ਆ ਜਾਇਓ ਅਤੇ ਜਿਹੜੇ ਜਿਹੜੇ ਤੁਹਾਨੂੰ ਇੱਕ ਵਾਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵੀ ਕਿਹੜੇ ਬੀਜ ਚਾਹੀਦੇ ਉਹ ਸਾਡੇ ਕੋਲ ਕੁਛ ਕੁ ਸਾਡੇ ਕੋਲ ਖਤਮ ਹੋਏ ਪਏ ਆ ਹੁਣ ਹਾਂ ਹਾਂ ਆਲੂ ਵੀ ਲਾ ਸਕਦੇ ਹੋ ਟਮਾਟਰ ਵੀ ਲਾ ਸਕਦੇ ਹੋ ਰੁੱਤ ਦੇ ਹਿਸਾਬ ਨਾਲ ਜਿਵੇਂ ਲਾ ਲਓ ਜਿਵੇਂ ਹੁਣ ਜਿਵੇਂ ਰੁੱਤ ਆ ਮਿਰਚ ਦੇ ਵੀ ਲਾ ਸਕਦੇ ਹੋ ਹਰੀਆ ਮਿਰਚਾਂ ਦੇ ਅਤੇ ਉਸ ਤੋਂ ਬਾਅਦ ਹਾਂਜੀ ਹਾਂਜੀ ਉਹ ਵੀ ਹੈਗੇ ਨੇ ਸ਼ਿਮਲਾ ਮਿਰਚ ਦੇ ਵੀ ਹੈਗੇ ਨੇ ਅਤੇ ਇਹਦੇ ਆਲੂ ਦੇ ਵੀ ਹੈਗੇ ਆ ਟਮਾਟਰ ਦੇ ਵੀ ਹੈਗੇ ਹੈ ਅਤੇ ਹਰੀਆਂ ਮਿਰਚਾਂ ਦੇ ਹੈਗੇ ਹੈ ਅਤੇ ਉਸ ਤੋਂ ਇਲਾਵਾ ਹੁਣ ਮੂਲੀ ਦੇ ਵੀ ਹੈਗੇ ਹੈ ਗਾਜਰਾਂ ਦੇ ਵੀ ਹੈ ਨਹੀਂ ਨਹੀਂ ਨਹੀਂ ਜੀ ਨਹੀਂ ਨਹੀਂ ਕੁਆਲਿਟੀ ਤਾਂ ਤੁਹਾਨੂੰ ਇੱਕ ਨੰਬਰ ਵਧੀਆ ਮਿਲੂਗੀ ਉਹ ਤੁਸੀਂ ਜਮਾਂ ਵੀ ਟੈਨਸ਼ਨ ਨਾ ਲਓ ਕੁਆਲਿਟੀ ਵਜੋਂ ਤਾਂ ਰੇਟ ਤੁਹਾਨੂੰ ਜਮਾ ਜਾਇਜ਼ ਲੱਗਣਗੇ ਜਿਵੇਂ ਮਤਲਬ ਤੁਸੀਂ ਕਿਤੋਂ ਦੁਕਾਨ ਤੋਂ ਦੂਜੀ ਦੁਕਾਨ ਤੋਂ ਟਰਾਈ ਕਰ ਲਿਓ ਜੇ ਤੁਹਾਨੂੰ ਉਸ ਰੇਟ ਦੇ ਵਿੱਚ ਉਸ ਕੁਆਲਿਟੀ ਦਾ ਕਿਤੇ ਬੀਜ ਮਿਲ ਜਾਵੇ ਤਾਂ ਫਿਰ ਤੁਸੀਂ ਆ ਕੇ ਸਾਨੂੰ ਕਹਿ ਦਿਓ ਉਹ ਕੋਈ ਦਿੱਕਤ ਨਹੀਂ ਤੁਸੀਂ ਥੋੜ੍ਹੇ ਜਿਹੇ ਵੀ ਲਓ ਤੁਸੀਂ ਇੱਕ ਵਾਰੀ ਥੋੜ੍ਹੇ ਜਿਹੇ ਲੈ ਕੇ ਜਾਓ ਤੁਸੀਂ ਇੱਕ ਅੱ ਇੱਕ ਵਾਰੀ ਐਂਈ ਕਰੋ ਇੱਕ ਅੱਧੀ ਸਬਜ਼ੀ ਦੇ ਲੈ ਜਾਓ ਅਤੇ ਤੁਸੀਂ ਉਹਨੂੰ ਵਰਤ ਕੇ ਦੇਖੋ ਫਿਰ ਜੇ ਤੁਹਾਨੂੰ ਰਿਜ਼ਲਟ ਵਧੀਆ ਮਿਲਿਆ ਫਿਰ ਤੁਸੀਂ ਦੁਬਾਰਾ ਆਇਓ ਫਿਰ ਤੁਸੀਂ ਹੋਰ ਲੈ ਕੇ ਜਾਇਓ ਅਤੇ ਇਹ ਗਰੰਟੀ ਹੈ ਵੀ ਤੁਸੀਂ ਪੱਕਾ ਆਓਗੇ ਦੁਬਾਰਾ ਹਾਂਜੀ ਹਾਂਜੀ ਉਹ ਮੁੰਡੇ ਰੱਖੇ ਪਏ ਆ ਉਹ ਦੱਸ ਦੇਣਗੇ ਕਿਹੜੇ ਕਿਹੜੇ ਹੈਗੇ ਆ ਤਾਂ ਤੁਸੀਂ ਇੱਕ ਵਾਰ ਦੁਕਾਨ 'ਤੇ ਆ ਜਾਇਓ ਦੁਕਾਨ ਦਾ ਐਡਰੈਸ ਤਾਂ ਤੁਹਾਨੂੰ ਪਤਾ ਹੀ ਹੋਊਗਾ ਹੋਮ ਡਿਲੀਵਰੀ ਤਾਂ ਮਿਲ ਜੂਗੀ ਪਰ ਗੱਲ ਇਹ ਹੈ ਵੀ ਤੁਸੀਂ ਇੱਕ ਵਾਰ ਆ ਕੇ ਚੰਗੀ ਤਰ੍ਹਾਂ ਮਤਲਬ ਜਾਂਚ ਪੜਤਾਲ ਕਰ ਲਓ ਵੀ ਕਿਹੜੇ ਕਿਹੜੇ ਬੀਜ ਹੈਗੇ ਆ ਉਹ ਐਵੇਂ ਹੈ ਨਾ ਹੁਣ ਫੋਨ ਤੇ ਇਨਾ ਕੁਝ ਦੱਸਿਆ ਵੀ ਨਹੀਂ ਜਾਂਦਾ ਨਾਲੇ ਹੁਣ ਮੁੰਡੇ ਰੱਖਦੇ ਆ ਸਾਰਾ ਰਿਕਾਰਡ ਆਪਣੇ ਕੋਲ ਵੀ ਕਿਹੜੇ ਕਿਹੜੇ ਨਵੇਂ ਆਏ ਆ ਕਿਹੜੇ ਕਿਹੜੇ ਹੁਣ ਹੈ ਨਹੀਂ ਖਤਮ ਹੋਏ ਪਏ ਆ ਇੱਕ ਵਾਰ ਤੁਸੀਂ ਜੇ ਆ ਜਾਂਦੇ ਤੁਹਾਡਾ ਘਰ ਕਿੱਧਰ ਨੂੰ ਪੈਂਦਾ ਅੱਛਾ ਅਤੇ ਕੋਈ ਗੱਲ ਨਹੀਂ ਫਿਰ ਤਾਂ ਅਮਰੀਕ ਸਿੰਘ ਨੇ ਰੋਡ ਤੋਂ ਤਾਂ ਨੇੜੇ ਹੀ ਪੈਂਦਾ ਦੁਕਾਨ ਦਾ ਐਡਰੈਸ ਤੁਸੀਂ ਇੱਕ ਵਾਰ ਆ ਜਾਓ ਠੀਕ ਹੈ ਅਤੇ ਆ ਕੇ ਦੇਖ ਲਓ ਠੀਕ ਹੈ ਆਉਣ ਤੋਂ ਪਹਿਲਾਂ ਇੱਕ ਵਾਰ ਫੋਨ ਕਰ ਲਿਓ ਹੁਣ ਥੋੜ੍ਹਾ ਸੀਜ਼ਨ ਦਾ ਕੰਮ ਚੱਲ ਰਿਹਾ ਠੀਕ ਹੈ ਕੋਈ ਗੱਲ ਨਹੀਂ ਆਪਣੀ ਸੰਡੇ ਨੂੰ ਵੀ ਖੁੱਲੀ ਹੁੰਦੀ ਹੈ ਦੁਕਾਨ ਸੰਡੇ ਨੂੰ ਆ ਜਾਇਓ ਠੀਕ ਹੈ ਠੀਕ ਹੈ ਜੀ ਓਕੇ ਜੀ